ਜੇਕਰ ਔਰਤਾਂ ਦੀ ਗੱਲ ਕੀਤੀ ਜਾਵੇ ਪਹਿਲਾਂ ਦੇ ਸਮੇਂ ਨਾਲੋਂ ਅੱਜ ਦੇ ਸਮੇਂ ਦੇ ਵਿੱਚ ਬਹੁਤ ਫਰਕ ਆ ਪਹਿਲਾਂ ਦੇ ਸਮੇਂ ਦੇ ਵਿੱਚ ਬੱਚਿਆਂ ਨੂੰ ਜ਼ਿਆਦਾਤਰ ਕੁੜੀਆਂ ਨੂੰ ਪੜ੍ਹਾਇਆ ਨਹੀਂ ਸੀ ਜਾਂਦਾ ਪਹਿਲਾਂ ਸਮੇਂ ਪਹਿਲਾਂ ਦੇ ਸਮੇਂ ਵਿੱਚ ਲੱਗਦਾ ਸੀ ਕਿ ਕੁੜੀਆਂ ਸਿਰਫ ਘਰ ਦੇ ਕੰਮ ਕਾਰ ਹੀ ਕਰ ਸਕਦੀਆਂ ਬਾਹਰ ਨਿਕਲ ਕੇ ਕੁਛ ਕੋਈ ਕੰਮ ਕਾਰ ਨਹੀਂ ਕਰ ਸਕਦੀਆਂ ਬਟ ਅੱਜ ਦੇ ਸਮੇਂ ਦੇ ਵਿੱਚ ਕੁੜੀਆਂ ਨੂੰ ਵੀ ਪੂਰਾ ਪੜ੍ਹਾਇਆ ਜਾਂਦਾ ਵਾ ਐਜੂਕੇਸ਼ਨ ਵੱਲ ਵੀ ਉਹਨਾਂ ਦੇ ਵੱਲ ਧਿਆਨ ਦਿੱਤਾ ਜਾਂਦਾ ਵਾ ਅਤੇ ਅੱਜ ਦੇ ਸਮੇਂ ਦੇ ਵਿੱਚ ਕੁੜੀਆਂ ਘਰੋਂ ਬਾਹਰ ਨਿਕਲ ਕੇ ਵੀ ਕੰਮ ਕਰਦੀਆਂ ਇਹਨਾਂ ਘਰ ਦੇ ਕੰਮ ਦੇ ਨਾਲ ਨਾਲ ਉਹ ਬਾਹਰ ਦੇ ਕੰਮ ਵਿੱਚ ਵੀ ਧਿਆਨ ਦਿੰਦੀਆਂ ਹਨ ਖੇਡਾਂ ਦੇ ਵਿੱਚ ਵੀ ਧਿਆਨ ਦਿੰਦੀਆਂ ਹਨ ਹਰ ਇੱਕ ਖੇਤਰ ਦੇ ਵਿੱਚ ਅੱਜ ਕੱਲ੍ਹ ਔਰਤਾਂ ਨੇ ਮੱਲਾਂ ਮਾਰੀਆਂ ਹਨ ਜਿਵੇਂ ਕਿ ਸਾਨੀਆ ਮਿਰਜ਼ਾ ਸਾਨੀਆਂ ਮਿਰਜ਼ਾ ਇੱਕ ਟੈਨਿਸ ਪਲੇਅਰ ਆ ਜੋ ਕਿ ਜਿਹਨੇ ਕਿ ਬਹੁਤ ਸਾਰੇ ਅਵੋਰਡਸ ਜਿੱਤੇ ਹਨ ਉਹ ਇੱਕ ਬੈਸਟ ਐਗਜਾਮਪਲ ਹੈਗੀ ਆ ਅੱਜ ਦੇ ਸਮੇਂ ਦੇ ਵਿੱਚ ਪਹਿਲਾਂ ਦੇ ਸਮੇਂ ਦੇ ਵਿੱਚ ਨਾ ਤਾਂ ਕੁੜੀਆਂ ਨੂੰ ਘਰੋਂ ਬਾਹਰ ਨਿਕਲਣ ਦਿੱਤਾ ਜਾਂਦਾ ਸੀ ਬਟ ਅੱਜ ਦੇ ਸਮੇਂ ਦੇ ਵਿੱਚ ਘਰੋਂ ਬਾਹਰ ਨਿਕਲ ਕੇ ਉਹ ਹਰ ਇੱਕ ਖੇਤਰ ਦੇ ਵਿੱਚ ਮੱਲਾਂ ਮਾਰ ਰਹੀਆਂ ਹਨ ਭਾਵੇਂ ਉਹ ਖੇਡਾਂ ਹੋਵੇ ਭਾਵੇਂ ਉਹ ਕੋਈ ਕੰਮ ਕਾਰ ਹੋਵੇ ਥੈਂਕ ਯੂ